ਮੇਰੇ ਖੇਤਰ ਵਿੱਚ ਕਈ ਖੇਡਾਂ ਖੇਡੀਆਂ ਜਾਂਦੀਆਂ ਲਾਈਕ ਕ੍ਰਿਕਟ ਫੁੱਟਬੋਲ ਬਾਸਕਿਟਬੋਲ ਕਬੱਡੀ ਵੋਲੀਵੋਲ ਬੈਡਮਿੰਟਨ ਇਹ ਸਾਰੇ ਖੇਡ ਮੇਰੇ ਖੇਤਰ ਵਿੱਚ ਖੇਡੇ ਜਾਂਦੇ ਹਨ ਬਟ ਮੈਂ ਕ੍ਰਿਕਟ ਦਾ ਨਾਮ ਲੈਣਾ ਚਾਹੁੰਦਾ ਕਿਉਂਕਿ ਮੈਂ ਵੀ ਕ੍ਰਿਕਟ ਖੇਡਦਾ ਹਾਂ ਅਤੇ ਮੈਂ ਇੱਕ ਨੈਸ਼ਨਲ ਲੈਵਲ 'ਤੇ ਟੀਮ ਨੂੰ ਰੀਪ੍ਰਜੈਂਟ ਕੀਤਾ ਅਤੇ ਮੈਨੂੰ ਕਾਫੀ ਅੰਦਰੋਂ ਪਤਾ ਕਿ ਕ੍ਰਿਕਟ ਕਿਵੇਂ ਖੇਡਦੇ ਹਨ ਲਾਈਕ ਜਿਵੇਂ ਸਾਡੇ ਇੱਥੇ ਇੱਕ ਵਿਕਟ ਲੱਗਦੀ ਹੈ ਦੋ ਵਿਕਟਾਂ ਲੱਗਦੀਆਂ ਦੋ ਖੇਤਰ ਵਿੱਚ ਸਾਨੂੰ ਇੱਕ ਬੈਟ ਦਿਆਂ ਜਾਂਦਾ ਬੈਟ ਹੁੰਦਾ ਸਾਡੇ ਕੋਲ ਇੱਕ ਬੋਲ ਹੁੰਦੀ ਹੈ ਅਤੇ ਸਾਨੂੰ ਬੋਲ ਲੈ ਬੋਲ ਪਾਉਣੀ ਹੁੰਦੀ ਹੈ ਅਤੇ ਇੱਕ ਬੈਟਸਮੈਨ ਨੂੰ ਬੈਟ ਲੈ ਕੇ ਬੋਲ ਨੂੰ ਹਿੱਟ ਕਰਨਾ ਹੁੰਦਾ ਅਤੇ ਜੇ ਬੋਲ ਬਾਉਂਡਰੀ ਦੇ ਸਿੱਧਾ ਬਾਹਰ ਜਾਏ ਅਸੀਂ ਛੇ ਰਨ ਇੰਕਲੂਡ ਕਰਦੇ ਹਨ ਅਤੇ ਜੇ ਰਿੜਦੀ ਰਿੜਦੀ ਜਾਵੇ ਫਿਰ ਅਸੀਂ ਚਾਰ ਰਨ ਦਿੰਦੇ ਹਨ ਅਤੇ ਜੇ ਬੋਲ ਉਹ ਵਿਕਟ 'ਤੇ ਲੱਗ ਗਈ ਤਾਂ ਫਿਰ ਬੈਟਸਮੈਨ ਆਊਟ ਹੁੰਦਾ ਅਤੇ ਬੈਟਸਮੈਨ ਨੂੰ ਫਿਰ ਬਾਹਰ ਜਾਣਾ ਪੈਂਦਾ ਅਤੇ ਅਗਲਾ ਬੈਟਸਮੈਨ ਆਉਂਦਾ ਫਿਰ ਇੱਕ ਟੀਮ 'ਚ ਗਿਆਰਾਂ ਪਲੇਅਰ ਹੁੰਦੇ ਹਨ ਅਤੇ ਟੀ ਇੱਕ ਮੈਂ ਇਹ ਮੈਚ ਦੋ ਟੀਮਾਂ 'ਚ ਖੇਡਿਆ ਜਾਂਦਾ ਅਤੇ ਇਹ ਕ੍ਰਿਕਟ ਵਿੱਚ ਤਿੰਨ ਤਿੰਨ ਫੋਰਮੈਟ ਹੁੰਦੇ ਨੇ ਟੈਸਟ ਮੈਚ ਜਿਹੜਾ ਪੰਜ ਦਿਨ ਦਾ ਹੁੰਦਾ ਆ ਪਰ ਡੇ ਨੱਬੇ ਨੱਬੇ ਓਵਰ ਹੁੰਦੇ ਨੇ ਵੰਨ ਡੇ ਇੰਟਰਨੈਸ਼ਨਲ ਹੁੰਦਾ ਜਿਹਦੇ ਵਿੱਚ ਪੰਜਾਹ ਓਵਰ ਹੁੰਦੇ ਨੇ ਟੀ ਟਵੰਟੀ ਫਾਰਮੈਟ ਹੁੰਦਾ ਜਿਹਦੇ ਵਿੱਚ ਵੀਹ ਓਵਰ ਹੁੰਦੇ ਨੇ ਅਤੇ ਇੱਕ ਓਵਰ ਵਿੱਚ ਛੇ ਬੋਲ ਹੁੰਦੀ ਹੈ ਅਤੇ ਬਟ ਅੱਜ ਕੱਲ੍ਹ ਕਾਫੀ ਕਾਫੀ ਨਵੇਂ ਨਵੇਂ ਫੋਰਮੈਟ ਆ ਗਏ ਹਨ ਜਿਵੇਂ ਸੌ ਬੋਲਾਂ ਦਾ ਇੱਕ ਮੈਚ ਹੁੰਦਾ ਉਹਦੇ ਵਿੱਚ ਪ ਇੱਕ ਓਵਰ ਪੰਜ ਬੋਲਾਂ ਦਾ ਹੁੰਦਾ ਐਦਾਂ ਐਦਾਂ ਕਰਕੇ ਹੁਣ ਕ੍ਰਿਕਟ ਕਾਫੀ ਇਨਵੋਲਵ ਹੁੰਦੀ ਜਾਂਦੀ ਹੈ ਅਤੇ ਕ੍ਰਿਕਟ ਕਾਫੀ ਵੱਡੀ ਹੁੰਦੀ ਜਾ ਰਹੀ ਹੈ ਜਿਵੇਂ ਇੰਡੀਆ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਕ੍ਰਿਕਟ ਤਿਉ ਕ੍ਰਿਕਟ ਟੂਰਨਾਮੈਂਟ ਹੈ ਆਈ ਪੀ ਐਲ ਇਹਦੇ ਵਿੱਚ ਦਸ ਟੀਮਾਂ ਹਨ ਨ ਵੱਖਰੇ ਵੱਖਰੇ ਸ਼ਹਿਰ ਦੀਆਂ ਟੀਮਾਂ ਨੂੰ ਨਾਮ ਦਿੱਤਾ ਗਿਆ ਹੈ ਜਿਵੇਂ ਚਨੱਈ ਸੁਪਰ ਕਿੰਗ ਰੋਇਲ ਚੈਲੇਂਜਿਸ ਬੈਂਗਲੋਰ ਰਾਜਸਥਾਨ ਰੋਇਲ ਦਿੱਲੀ ਕੈਪੀਟਲਜ਼ ਅਤੇ ਇਸ ਅਤੇ ਆਈ ਪੀ ਐਲ ਦੇ ਵਿੱਚ ਜਿਵੇਂ ਕਿ ਇਹ ਇੰਡੀਆ ਦਾ ਇੰਡੀਆ ਦਾ ਕ੍ਰਿਕਟ ਟੂਰਨਾਮੈਂਟ ਹੈ ਅ ਪਰ ਟੀਮ ਵਿੱਚ ਸਿਰਫ ਚਾਰ ਹੀ ਬਾਹਰ ਦੇ ਖਿਡਾਰੀ ਹੋ ਸਕਦੇ ਆ ਅਤੇ ਸੱਤ ਸਾਨੂੰ ਖਿਡਾਰੀ ਖਿਡਾਉਣੇ ਪੈਂਦੇ ਹਨ ਅਤੇ ਕ੍ਰਿਕਟਰਾਂ ਬਾਰੇ ਕ੍ਰਿਕਟਰ ਕਾਫੀ ਫੇਮਸ ਹੁੰਦੇ ਨੇ ਜਿਵੇਂ ਇੰਡੀਆ ਦਾ ਇੱਕ ਬਹੁਤ ਫੇਮਸ ਕ੍ਰਿਕਟਰ ਹੈ ਵਿਰਾਟ ਕੋਹਲੀ ਉਹਨੂੰ ਕ੍ਰਿਕਟ ਦਾ ਸਭ ਤੋਂ ਵੱਡਾ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਉਹ ਹੁਣ ਗੇਮ ਤੋਂ ਵੱਡਾ ਹੋ ਗਿਆ ਹੈ ਉਹ ਇੰਨਾ ਪਾਪੂਲਰ ਹੋ ਗਿਆ ਕਿ ਉਹਨੇ ਆਪਣੇ ਇਕੱਲੇ ਦੇ ਬਲਬੂਤੇ 'ਤੇ ਕ੍ਰਿਕਟ ਨੂੰ ਓਲੰਪਿਕਸ ਦੇ ਵਿੱਚ ਇੰਕਲੂਡ ਕੀ ਕਰਵਾਇਆ ਹੈ ਬਾਹਰ ਵਿਰਾਟ ਕੋਹਲੀ ਨੂੰ ਕਾਫੀ ਰਿਸਪੈਕਟ ਦੇਈ ਜਾਂਦੀ ਹੈ ਅਤੇ ਕ੍ਰਿਕਟ ਨੂੰ ਕਾਫੀ ਜਗ੍ਹਾ 'ਤੇ ਖੇਡਿਆ ਜਾਂਦਾ ਹੈ ਕਈ ਲੋਕ ਇੱਦਾਂ ਵੀ ਹੁੰਦੇ ਜਿਹੜੇ ਕ੍ਰਿਕਟ ਅਤੇ ਫੁੱਟਬੋਲ ਨੂੰ ਕੰਪੇਅਰ ਕਰਦੇ ਹਨ ਬਟ ਮੈਂ ਮੰਨਦਾ ਕਿ ਕ੍ਰਿਕਟ ਅਤੇ ਫੁੱਟਬੋਲ ਨੂੰ ਕਦੇ ਕੰਪੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਦੋਵੇਂ ਹੀ ਬਹੁਤ ਵਧੀਆ ਸਪੋਰਟਸ ਨੇ ਅਤੇ ਵੱਡੇ ਵੱਡੇ ਲੋਕ ਇਸ ਸਪੋਰਟਸ ਨੂੰ ਖੇਡਦੇ ਹਨ ਬਸ ਮੈਂ ਇਨੀ ਖੇਡ ਕਹਿਣਾ ਚਾਹੁੰਦਾ ਹਾਂ ਕਿ ਕ੍ਰਿਕਟ ਗੇਮ ਬਹੁਤ ਪਿਆਰੀ ਅਤੇ ਬਹੁਤ ਸੁੰਦਰ ਹੈ ਸਾਰਿਆਂ ਨੂੰ ਇਹ ਗੇਮ ਖੇਡਣੀ ਚਾਹੀਦੀ ਹੈ ਕਿਉਂਕਿ ਕ੍ਰਿਕਟ ਕਦੇ ਕਿਸੇ ਨੂੰ ਕਿਸੇ ਦਾ ਦਿਲ ਨਹੀਂ ਤੋੜਦੀ ਕਦੇ ਕਿਸੇ ਦੀ ਭਾਵਨਾ ਨਾਲ ਨਹੀਂ ਖੇਡਦੀ ਅਤੇ ਸਾਨੂੰ ਕ੍ਰਿਕਟ ਖੇਡਣਾ ਚਾਹੀਦਾ ਹੈ ਤਾਂ ਕਿ ਅਸ ਅਸੀਂ ਫਿੱਟ ਰਹੀਏ ਅਤੇ ਸਾਨੂੰ ਅਤੇ ਅਸੀਂ ਕੋਈ ਫਿਟ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਬਹੁਤ ਜਲਦੀ ਬਿਮਾਰ ਪੈ ਜਾਂਗੇ ਅਤੇ ਸਾਡੀ ਲਾਈਫ ਉਨੀ ਹੀ ਘੱਟ ਹੋਈ ਜਾਂਦੀ ਹੈ ਅਤੇ ਤੁਸੀਂ ਜਿਹੜੀ ਮਰਜ਼ੀ ਸਪੋਰਟ ਖੇਡੋ ਬਟ ਸਾਰਿਆਂ ਨੂੰ ਖੇਡਣਾ ਚਾਹੀਦਾ ਹੈ ਕੋਈ ਇਹੋ ਜਿਹੇ ਨਾ ਹੋਵੇ ਜਿਹੜਾ ਘਰ ਬੈਠੇ ਬੈਠੇ ਸਿਰਫ਼ ਪੜ੍ਹਦਾ ਹੋਵੇ ਜਾਂ ਘਰ ਹੀ ਬੈਠਾ ਕੋਈ ਔਨਲਾਈਨ ਗੇਮ ਖੇਡਦਾ ਹੋਵੇ ਸਾਨੂੰ ਸਾਰਿਆਂ ਨੂੰ ਬਾਹਰ ਆ ਕੇ ਖੇਡਣਾ ਚਾਹੀਦਾ ਹੈ